ਜੀ ਮੈਨੂੰ ਨੱਚਣ ਦਾ ਸ਼ੌਂਕ ਡਾਂਸ ਦਾ ਸ਼ੌਂਕ ਤਾਂ ਬਚਪਨ ਤੋਂ ਹੀ ਸੀ ਇਹ ਤਾਂ ਮੈਂ ਸਭ ਤੋਂ ਪਹਿਲਾਂ ਡਾਂਸ ਵਿੱਚ ਆਪਣੇ ਸਕੂਲ ਦੇ ਸਮੇਂ ਵਿੱਚ ਆਪਾਂ ਜਿਹੜੀ ਕਲਾਸ ਵਿੱਚ ਡਾਂਸ ਪ੍ਰਤਿਯੋਗਿਤਾ ਵਿੱਚ ਭਾਗ ਲਿਆ ਸੀ ਇਹ ਡਾਂਸ ਸਾਡਾ ਗਰੁੱਪ ਡਾਂਸ ਸੀਗਾ ਅਤੇ ਇਸ ਲਈ ਅਸੀਂ ਇੱਕ ਰਾਜਸਥਾਨੀ ਗਾਨਾ ਚੂਜ਼ ਕੀਤਾ ਸੀਗਾ ਉਹ ਗਾਣਾ ਸੀ ਘੂਮਰ ਮਤਲਬ ਉਹਦੇ ਲਈ ਅਸੀਂ ਪੂਰਾ ਰਾਜਸਥਾਨੀ ਜਿਹੜਾ ਉਹ ਸੀ ਸਟਾਈਲ ਲੁੱਕ ਵਰਤਿਆ ਸੀਗਾ ਤਾਂ ਕਰਕੇ ਵੈਸੇ ਵੀ ਇੱਕ ਡਾਂਸ ਉਦੋਂ ਹੀ ਵਧੀਆ ਲੱਗਦਾ ਹੈ ਜਦੋਂ ਆਪਾਂ ਉਹ ਡਾਂਸ ਦਾ ਪੂਰਾ ਗੈਟਅਪ ਉਸ ਤਰੀਕੇ ਨਾਲ ਵਰਤੀਏ ਜਿਸ ਤਰੀਕੇ ਨਾਲ ਆਪਾਂ ਗਾਣਾ ਲਿਆ ਹੈ ਤਾਂ ਅਸੀਂ ਮਤਲਬ ਕਿ ਡਾਂਸ ਲਈ ਸਭ ਤੋਂ ਪਹਿਲਾਂ ਤਾਂ ਮਤਲਬ ਆਪਣੇ ਚਿਹਰੇ 'ਤੇ ਉਹ ਵੀ ਦਿਖਾਣਾ ਚਾਹੀਦਾ ਹੈ ਅਤੇ ਆਪਾਂ ਕਿਸ ਤਰ੍ਹਾਂ ਦਾ ਡਾਂਸ ਕਰ ਰਹੇ ਹਾਂ ਜੋ ਜੋਸ਼ ਆਪਣੇ ਡਾਂਸ ਵਿੱਚ ਆ ਰਿਹਾ ਉਹੀ ਜੋਸ਼ ਆਪਣੇ ਫੇਸ 'ਤੇ ਵੀ ਨਜ਼ਰ ਆਉਣਾ ਚਾਹੀਦਾ ਹੈ ਹੈਗਾ ਤਾਂ ਕਰਕੇ ਪਹਿਲੀ ਵਾਰ ਜਦੋਂ ਅਸੀਂ ਡਾਂਸ ਕੀਤਾ ਸੀ ਤਾਂ ਉਹ ਡਾਂਸ ਸਭ ਨੂੰ ਬਹੁਤ ਹੀ ਪਸੰਦ ਆਇਆ ਸੀਗਾ ਮੈਨੂੰ ਖੁਦ ਨੂੰ ਬਹੁਤ ਵਧੀਆ ਲੱਗਿਆ ਉਹ ਡਾਂਸ ਕਰਕੇ ਤਾਂ ਉਦੋਂ ਤਾਂ ਅਸੀਂ ਪੰਜਵੀਂ ਕਲਾਸ 'ਚ ਹੁੰਦੇ ਸੀ ਜਦੋਂ ਅਸੀਂ ਡਾਂਸ ਕੀਤਾ ਸੀਗਾ ਤਾਂ ਇਹ ਡਾਂਸ ਸਾਨੂੰ ਟੀਚਰ ਸਾਡੇ ਸਕੂਲ ਦੇ ਜਿਹੜੇ ਟੀਚਰ ਸੀ ਸ਼ਿਕਸ਼ਕ ਸੀਗੇ ਉਹਨਾਂ ਨੇ ਦਿਖਾਇਆ ਸੀ ਅਸੀਂ ਦੇਖ ਕੇ ਜਦੋਂ ਪ੍ਰੈਕਟਿਸ ਕੀਤੀ ਡਾਂਸ ਦੀ ਤਾਂ ਸਭ ਨੂੰ ਸਾਡਾ ਡਾਂਸ ਜਿਹੜਾ ਬਹੁਤ ਪਸੰਦ ਆਇਆ ਸੀਗਾ ਅਤੇ ਇਹ ਉਦੋਂ ਤੋਂ ਹੀ ਮੈਨੂੰ ਹੋਰ ਹੌਂਸਲਾ ਹੋ ਗਿਆ ਮਨ 'ਚ ਵੀ ਮੈਂ ਡਾਂਸ ਵਧੀਆ ਤਰੀਕੇ ਨਾਲ ਹੋਰ ਕਰ ਸਕਦੀ ਹਾਂ ਤਾਂ ਐਵੇਂ ਸਕੂਲ 'ਚ ਹੋਰ ਵੀ ਪ੍ਰਤੀਗ ਪ੍ਰਤੀਯੋਗਿਤਾ ਪ੍ਰੋਗਰਾਮ ਆਉਂਦੇ ਰਹੇ ਡਾਂਸ ਦੇ ਤਾਂ ਮੈਂ ਉਹਨਾਂ 'ਚ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਮੇਰੀ ਡਾਂਸ ਵਿੱਚ ਜਿਹੜੀ ਦਿਲਚਸਪੀ ਆ ਉਹ ਹੋਰ ਵੱਧ ਗਈ ਅਤੇ ਮੇਰੇ ਅੰਦਰ ਹੋਰ ਵੀ ਹੌਂਸਲਾ ਆ ਗਿਆ ਵੀ ਮੈਂ ਡਾਂਸ ਕਰ ਸਕਦੀ ਹਾਂ ਇੱਕ ਤਾਂ ਇਹ ਮੇਰਾ ਸ਼ੌਂਕ ਸੀ ਡਾਂਸ ਦੂਸਰਾ ਜਦੋਂ ਮੈਂ ਪਹਿਲੀ ਵਾਰ ਡਾਂਸ ਕੀਤਾ ਤਾਂ ਸਭ ਨੇ ਬਹੁਤ ਹੀ ਤਾਰੀਫ ਕੀਤੀ ਮੇਰੀ ਵੀ ਬਹੁਤ ਅੱਛਾ ਡਾਂਸ ਬਹੁਤ ਵਧੀਆ ਡਾਂਸ ਕੀਤਾ ਤਾਂ ਕਰਕੇ ਇਹ ਮੈਂ ਇਹ ਡਾਂਸ ਦੁਬਾਰਾ ਵੀ ਬਹੁਤ ਵਾਰੀ ਕੀਤਾ ਸੀ ਬਹੁਤ ਵਾਰੀ ਪ੍ਰੋਗਰਾਮ 'ਚ ਵੀ ਹਿੱਸਾ ਲਿਆ ਤਾਂ ਕਿ ਮੈਂ ਆਪਣੇ ਡਾਂਸ ਦੇ ਜਿਹੜੇ ਸਕਿਲ ਆ ਉਹਨਾਂ 'ਚ ਹੋਰ ਜ਼ਿਆਦਾ ਵਧੀਆ ਉਹ ਜਾਂ ਬਹੁਤ ਨਿਪੁੰਨ ਹੋ ਜਾਂ ਸੋ ਬਸ ਇੰਨਾਂ ਹੀ ਸੀਗਾ ਤਾਂ ਤੁਸੀਂ ਵੀ ਮਤਲਬ ਕਿ ਜੇਕਰ ਡਾਂਸ ਸਿੱਖਣਾ ਹੈ ਤਾਂ ਤੁਸੀਂ ਬੇਸਿਕ ਓਤੋਂ ਸ਼ੁਰੂ ਕਰੋਂਗੇ ਧੰਨਵਾਦ